ਮੈਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਰਹਿੰਦੀ ਹਾਂ ਇੱਥੋਂ ਦੇ ਲੋਕ ਕਾਫੀ ਸਿਹਤਮੰਦ ਹਨ ਕਿਉਂਕਿ ਉਹਨਾਂ ਨੂੰ ਦੌੜਨਾ ਪਸੰਦ ਹੈ ਅਤੇ ਇੱਥੇ ਦੇ ਪੋਲੋ ਗਰਾਊਂਡ ਕਾਫੀ ਲੋਕ ਅੰ ਜਾਂਦੇ ਹਨ ਅਗਰ ਕੋਈ ਵੀ ਇਵੈਂਟ ਜਾਂ ਔਰ ਔਰਗਨਾਈਜ਼ ਹੁੰਦਾ ਹੈ ਸਕੂਲਾਂ ਦੇ ਬੱਚੇ ਕਾਫੀ ਦੌੜਨ ਇੱਥੇ ਆਉਂਦੇ ਹਨ ਅਤੇ ਦੌੜਨਾ ਵੈਸੇ ਵੀ ਬਹੁਤ ਹੀ ਵਧੀਆ ਹੈ ਅਤੇ ਸਿਹਤ ਲਈ ਬਹੁਤ ਹੀ ਕਾਫੀ ਸਿਹਤਮੰਦ ਵੀ ਹੈ ਅਤੇ ਸਾਨੂੰ ਹਲੇ ਵੀ ਯਾਦ ਗੱਲ ਯਾਦ ਜਦ ਮੈਂ ਆਪਣੇ ਸਕੂਲ ਦੇ ਸਮੇਂ ਦੇ ਵਿੱਚ ਦੌੜਨ ਜਾਂਦੀ ਸੀ ਤਾਂ ਸਾਨੂੰ ਉੱਥੇ ਡਾਈਟ ਵਗੈਰਾ ਵੀ ਦਿੱਤੀ ਜਾਂਦੀ ਸੀ ਅਸੀਂ ਸਮੇਂ ਸਿਰ ਹਰ ਬੱਚਾ ਇੱਕ ਦੌੜ ਜ਼ਰੂਰ ਲਗਾਉਂਦਾ ਸੀ ਅਗਰ ਕੋਈ ਰੇਸ ਹੁੰਦੀ ਸੀ ਸਭ ਨੂੰ ਇਕੱਠੇ ਦੌੜਾਇਆ ਜਾਂਦਾ ਸੀ ਅਤੇ ਸਕੂਲਾਂ ਦੇ ਬੱਚੇ ਕਾਫੀ ਆਇਆ ਕਰਦੇ ਹਨ ਅਤੇ ਉੱਥੇ ਹਰੇਕ ਔਰਗਨਾਈਜ ਕੀਤਾ ਉੱਥੇ ਦਾ ਪ੍ਰਾਈਜ਼ਿਜ਼ ਵੀ ਦਿੱਤੇ ਜਾਂਦੇ ਹਨ ਅਤੇ ਲੋਕ ਜ਼ਿਆਦਾ ਤੋਂ ਜਿਆਦਾ ਉਤ ਉੱਥੇ ਲੋਕ ਦੌੜਨਾ ਆਉਂਦੇ ਹਨ ਅਤੇ ਉਹਨਾਂ ਨੂੰ ਦੌੜਨਾ ਵੀ ਪਸੰਦ ਹੈ ਸਕੂਲਾਂ ਦੇ ਬੱਚਿਆਂ ਨੂੰ ਕਾਫੀ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ ਦੌੜਨ ਲਈ ਉਹਨਾਂ ਲਈ ਕਾਫੀ ਇਵੈਂਟਸ ਵੀ ਕੀਤੇ ਜਾਂਦੇ ਹਨ ਅਤੇ ਪ੍ਰੋਗਰਾਮ ਵੀ ਰੱਖੇ ਜਾਂਦੇ ਹਨ ਲੋਕ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਇਸ ਲਈ ਦੌੜਨਾ ਪਸੰਦ ਕਿਉਂਕਿ ਇਹ ਸਿਹਤ ਲਈ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਆਪਣੇ ਫਿਜ਼ੀਕਸ ਲਈ ਵੀ ਕਾਫੀ ਵਧੀਆ ਅਤੇ ਸਾਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਿਹਤਮੰਦ ਹੁੰਦੇ ਹਨ ਲੋਕ ਲੋਕ ਸਕੂਲਾਂ ਦੇ ਵਿੱਚ ਹਰ ਅਧਿਆਪਕ ਵੀ ਬੱਚਿਆਂ ਨੂੰ ਕੋਈ ਵੀ ਈਵੈਂਟਸ ਹੋਵੇ ਅਤੇ ਉਹ ਗਰਾਊਂਡ ਦੇ ਵਿੱਚ ਲੈ ਜਾਂਦੇ ਹਨ ਅਤੇ ਹਰ ਇੱਕ ਗੇਮ ਵਿੱਚ ਪਾਉਂਦੇ ਹਨ ਅਤੇ ਦੌੜਨਾ ਵੀ ਇੱਕ ਗੇਮ ਹੀ ਹੈ ਅਤੇ ਕਸਰਤ ਹੈ ਜੋ ਕਿ ਸਿਹਤ ਨੂੰ ਬਹੁਤ ਹੀ ਸ ਵਧੀਆ ਰੱਖਦੀ ਹੈ ਅਗਰ ਮੈਨੂੰ ਅੱਗੇ ਕਦੇ ਮੌਕਾ ਮਿਲੇ ਦੌੜਨ ਲਈ ਤਾਂ ਮੈਂ ਜ਼ਰੂਰ ਦੌੜਾਂਗੀ